ਪੰਜਾਬ ਦੇ ਸਮਾਜਿਕ ਅਤੇ ਸੱਭਿਆਚਾਰ ਖੇਤਰ ਵਿੱਚ ਕਲਾ ਅਤੇ ਸ਼ਿਲਪਕਾਰੀ ਦਾ ਬਹੁਤ ਮਹੱਤਵ ਹੈ ਕਲਾ ਅਤੇ ਸ਼ਿਲਪਕਾਰੀ ਮੁੱਢ ਯੁੱਗ ਤੋਂ ਹੀ ਪੰਜਾਬ ਵਿੱਚ ਚੱਲਦੀ ਆ ਰਹੀ ਹੈ ਪੁਰਾਣੇ ਸਮੇਂ ਵਿੱਚ ਕੁੜੀਆਂ ਕੰਧਾਂ 'ਤੇ ਚਿੱਤਰਕਾਰੀ ਕਰਦੀਆਂ ਸਨ ਅਤੇ ਫੁਲਕਾਰੀਆਂ ਬਣਾਉਂਦੀਆਂ ਸਨ ਜਿਸ ਉੱਪਰ ਉਹ ਸੋਹਣੇ ਸੋਹਣੇ ਡਿਜ਼ਾਇਨ ਬਣਾਉਂਦੀਆਂ ਸਨ ਕੁੜੀਆਂ ਚਾਦਰਾਂ 'ਤੇ ਕਸੀਦਾ ਕੱਢਦੀਆਂ ਸਨ ਅਤੇ ਉਹਨਾਂ ਉੱਪਰ ਮੋਰ ਘੁੱਗੀਆਂ ਚਿੜੀਆਂ ਤੋਤੇ ਅਤੇ ਫੁੱਲ ਬੂਟੇ ਬਣਾਉਂਦੀਆਂ ਸਨ ਪੰਜਾਬ ਇੱਕ ਅਜਿਹੀ ਸਟੇਟ ਹੈ ਜਿਸ ਵਿੱਚ ਕਲਾ ਅਤੇ ਸੱਭਿਆਚਾਰ ਦਾ ਸੰਪੂਰਨ ਮਿਸ਼ਰਣ ਮਿਲਦਾ ਹੈ ਪੰਜਾਬ ਮੁੱਢ ਤੋਂ ਹੀ ਸੱਭਿਆਚਾਰਕ ਵਿਰਾਸਤ ਵਿੱਚ ਅਮੀਰ ਸੀ ਪੁਰਾਣੇ ਸਮੇਂ ਵਿੱਚ ਕੁੜੀਆਂ ਕਵਰਾਂ 'ਤੇ ਗੱਦੀਆਂ 'ਤੇ ਚਾਦਰਾਂ 'ਤੇ ਕਢਾਈਆਂ ਕੱਢਦੀਆਂ ਸਨ ਪੁਰਾਣੇ ਸਮੇਂ ਦੇ ਲੋਕਾਂ ਦੇ ਖੂਨ ਵਿੱਚ ਹੀ ਕਲਾ ਸੀ ਮਿੱਟੀ ਦੇ ਭਾਂਡਿਆਂ 'ਤੇ ਬਹੁਤ ਸੋਹਣੀ ਚਿੱਤਰਕਾਰੀ ਕੀਤੀ ਜਾਂਦੀ ਸੀ ਪੁਰਾਣੇ ਸਮੇਂ ਵਿੱਚ ਕਲਾ ਨੂੰ ਉਤਸ਼ਾਹਿਤ ਕਰਨ ਲਈ ਕੋਈ ਖੇਤਰ ਨਹੀਂ ਸੀ ਬਣਾਏ ਗਏ ਜੇਕਰ ਅੱਜ ਦੇ ਯੁੱਗ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਲੋਕਾਂ ਦਾ ਕਲਾ ਅਤੇ ਸ਼ਿਲਪਕਾਰੀ ਤੋਂ ਮਨ ਉੱਠਿਆ ਹੈ ਉਹ ਹੁਣ ਚਿੱਤਰਕਾਰੀ ਨਹੀਂ ਕਰਦੇ ਅੱਜ ਕੱਲ੍ਹ ਦੇ ਬੱਚੇ ਤਾਂ ਮੋਬਾਇਲ ਫ਼ੋਨ 'ਤੇ ਟੀ ਵੀ ਵਿੱਚ ਹੀ ਮਸਤ ਰਹਿੰਦੇ ਹਨ ਉਹਨਾਂ ਵਿੱਚ ਕਲਾ ਅਤੇ ਚਿੱਤਰਕਾਰੀ ਬਹੁਤ ਘੱਟ ਗਈ ਹੈ ਅੱਜ ਕੱਲ੍ਹ ਬੱਚਿਆਂ ਨੂੰ ਚਿੱਤਰਕਾਰੀ ਕਰਨਾ ਪਸੰਦ ਨਹੀਂ ਹੈ ਸਰਕਾਰ ਨੇ ਕਲਾ ਅਤੇ ਸ਼ਿਲਪਕਾਰੀ ਨੂੰ ਵਧਾਉਣ ਲਈ ਕਈ ਆਰਟ ਸੈਂਟਰ ਖੋਲ੍ਹੇ ਹਨ ਪਰ ਜੋ ਪੁਰਾਣੇ ਸਮੇਂ ਦੀ ਕਲਾ ਸੀ ਉਸਦਾ ਮੁਕਾਬਲਾ ਅੱਜ ਦੀ ਕਲਾ ਨਾਲ਼ ਨਹੀਂ ਕੀਤਾ ਜਾ ਸਕਦਾ ਜੋ ਪੁਰਾਣੇ ਸਮੇਂ ਦੀ ਕਲਾ ਸੀ ਉਹ ਬਹੁਤ ਹੀ ਸੁੰਦਰ ਅਤੇ ਬਹੁਤ ਹੀ ਵਧੀਆ ਕਲਾ ਸੀ ਉਸਨੂੰ ਅੱਜ ਦੀ ਕਲਾ ਦੇ ਨਾਲ਼ ਨਹੀਂ ਤੋਲਿਆ ਜਾ ਸਕਦਾ ਧੰਨਵਾਦ